ਸਾਡੇ ਖੇਤਰ ਵਿੱਚ ਬਹੁਤ ਹੀ ਕਬਾਇਲੀ ਕਲਾਵਾਂ ਹਨ ਜਿਵੇਂ ਕਿ ਘਰਾਂ ਵਿੱਚ ਸਿਲਾਈ ਕਢਾਈ ਦਾ ਕੰਮ ਹਾਲੇ ਵੀ ਕੀਤਾ ਜਾਂਦਾ ਹੈ ਸਾਡੇ ਪਹਿਲਾਂ ਬਜ਼ੁਰਗ ਕਰਦੇ ਹੁੰਦੇ ਸੀ ਉਹਨਾਂ ਨੇ ਸਾਨੂੰ ਸਿਖਾਇਆ ਅਸੀਂ ਅੱਗੇ ਤੋਂ ਆਪਣੇ ਬੱਚਿਆਂ ਨੂੰ ਥੋੜ੍ਹਾ ਬਹੁਤ ਸਿਖਾ ਰਹੇ ਹਾਂ ਕਿ ਇਹ ਕਲਾਵਾਂ ਕਦੇ ਬੰਦ ਨਾ ਹੋ ਜਾਣ ਅੱਗੇ ਤੋਂ ਅੱਗੇ ਚੱਲਦੀਆਂ ਰਹਿਣ